ਕਪੂਰਥਲਾ ਜ਼ਿਲ੍ਹੇ ਦੀ ਨੀਂਹ ਗਿਆਰ੍ਹਵੀਂ ਸਦੀ ਵਿੱਚ ਮੁਹੰਮਦ ਗਜਨੀ ਦੇ ਰਾਜ ਕਾਲ ਦੌਰਾਨ ਰਾਣਾ ਕਪੂਰ ਸਿੰਘ ਨੇ ਰੱਖੀ ਸੀ ਕਪੂਰਥਲਾ ਜ਼ਿਲ੍ਹੇ ਨੂੰ ਦੇਖਿਆ ਜਾਵੇ ਤਾਂ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਇੱਕ ਸਾਈਡ ਜਲੰਧਰ ਅਤੇ ਦੂਜੀ ਸਾਈਡ ਅੰਮ੍ਰਿਤਸਰ ਕਪੂਰਥਲੇ ਵਿੱਚ ਵੈਸੇ ਲੜਾਈਆਂ ਤਾਂ ਨਹੀਂ ਹੋਈਆਂ ਇੱਥੇ ਮੋਰਚੇ ਲੱਗੇ ਹੋਏ ਸੀ ਜਿਵੇਂ ਕਿ ਪੁਰਾਣੇ ਸਮੇਂ ਵਿੱਚ ਜਿਹੜੀਆਂ ਗੁਰੂ ਘਰ ਦੀ ਚਾਬੀਆਂ ਉਹ ਮਸੰਦਾਂ ਦੇ ਕੋਲ ਹੁੰਦੀਆਂ ਸੀ ਪਰ ਅੱਜ ਉਹਨਾਂ ਚਾਬੀਆਂ ਨੂੰ ਲੈਣ ਲਈ ਇੱਥੇ ਮੋਰਚੇ ਲਗਾਏ ਗਏ ਸੀ ਪਰ ਸ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਲੜਾਈਆਂ ਨਾਲ ਲੱਗਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਹੋਈਆਂ ਜਿੱਥੇ ਕਿ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹ ਹਰਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਬਹੁਤ ਲੜਾਈਆਂ ਲੜੀਆਂ ਅਤੇ ਜਿ ਜਿਹਨਾਂ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਮੇਰੀ ਜਿ ਜ਼ਿੰਦਗੀ ਦੀ ਵਿੱਚ ਇੱਕ ਘਟਨਾ ਦਾ ਅਨੁਭਵ ਕਰਦਾ ਹਾਂ ਕਿ ਜਿਵੇਂ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਮੱਸੇ ਰੰਗੜ ਵੱਲੋਂ ਕੰਜਰੀਆਂ ਨਚਾਈਆਂ ਜਾਂਦੀਆਂ ਸਨ ਸ਼ਰਾਬਾਂ ਪੀਤੀਆ ਜਾਂਦੀਆਂ ਸਨ ਅਤੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਸਰ ਦੀ ਸੀ ਉਸ 'ਤੇ ਬਹੁਤ ਜ਼ਿਆਦਾ ਰੋਕ ਲੱਗੀ ਹੈ ਅਤੇ ਅੱਜ ਉੱਥੇ ਸੇਫ ਮਹਿਸੂਸ ਕੀਤਾ ਜਾਂਦਾ ਹਰੇਕ ਬੰਦਾ ਉੱਥੇ ਆਦਰ ਭਾਵ ਨਾਲ ਆਪਣਾ ਮੱਥਾ ਟੇਕਦਾ ਹੈ ਅਤੇ ਉੱਥੇ